ਮੰਦੇ ਖਿਆਲ ਬਦੀ ਦੇ ਹਰਕਾਰੇ ਹਨ ਜਦੋਂ ਇਹ ਹੋਰਨਾਂ ਤੱਕ ਪਹੁੰਚਦੇ ਹਨ ਤਾਂ ਇਹਨਾਂ ਨੂੰ ਹੋਰ ਵੀ ਉਕਸਾਉਂਦੇ ਵਧਾਉਂਦੇ ਅਤੇ ਇਹਨਾਂ ਨੂੰ ਬਲਵਾਨ ਬਣਾ ਕੇ ਦੂਜਿਆਂ ਤੱਕ ਪਹੁੰਚਾਉਂਦੇ ਹਨ

ਜੇ ਮਨ ਵਿੱਚ ਕੋਈ ਵੀ ਮੰਦਾ ਖਿਆਲ ਆਉਂਦਾ ਹੈ ਤਾਂ ਇਹ ਜਿਹੜੀਆਂ ਪੰਗਤੀਆਂ ਨੇ ਇਹ ਮੇਰੇ ਆਵਾਜ਼ ਵਿੱਚ ਬਹੁਤ ਗੂੰਜਦੀਆਂ ਹਨ ਅਤੇ ਇਸ ਕਰਕੇ ਮੈਂ ਇਹਦਾ ਹਵਾਲਾ ਦਿੰਦਾ ਹਾਂ ਅਤੇ ਇਸ ਨੂੰ ਸੰਬੰਧਿਤ ਮਹਿਸੂਸ ਕਰਦਾ ਹਾਂ